ਮੈਂ ਆਪਣੇ ਪਰਿਵਾਰ ਨਾਲ਼ ਸ਼ਿਮਲੇ ਗਈ ਸੀ ਸ਼ਿਮਲੇ ਦਾ ਵਾਤਾਵਰਨ ਬਹੁਤ ਠੰਡਾ ਹੈ ਅਤੇ ਉੱਥੇ ਬਹੁਤ ਬਰਫ਼ ਪੈਂਦੀ ਹੈ ਸ਼ਿਮਲੇ ਵਿੱਚ ਮੈਨੂੰ ਖੋਤਿਆਂ ਦੀ ਚੜ੍ਹਾਈ ਕਰਨੀ ਬਹੁਤ ਵਧੀਆ ਲੱਗੀ ਉਸ ਤੋਂ ਬਾਅਦ ਅੰਮ੍ਰਿਤਸਰ ਵੀ ਗਈ ਸੀ ਅਤੇ ਜਿੱਥੇ ਅੰਮ੍ਰਿਤਸਰ ਵਿੱਚ ਵਾਘਾ ਬਾਰਡਰ ਮੈਨੂੰ ਬਹੁਤ ਵਧੀਆ ਲੱਗਿਆ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਪਰੇਡ ਦੇਖ ਕੇ ਮੇਰਾ ਮਨ ਬਹੁਤ ਉਤਸ਼ਾਹਿਤ ਹੋਇਆ ਆਮ ਖਾਸ ਬਾਗ਼ ਜੋ ਕਿ ਸਰਹਿੰਦ ਵਿੱਚ ਹੈ ਉੱਥੇ ਇੱਕ ਬਹੁਤ ਵਧੀਆ ਸਟੇਜ ਬਣਿਆ ਹੋਇਆ ਹੈ ਜਿੱਥੇ ਕੁੜੀਆਂ ਤੀਆਂ ਦੇ ਤਿਉਹਾਰ 'ਤੇ ਪੀਂਘਾਂ ਝੂਟਦੀਆਂ ਹਨ ਅਤੇ ਗਿੱਧਾ ਅਤੇ ਭੰਗੜਾ ਕਰਦੀਆਂ ਹਨ ਉੱਥੇ ਫੋਟੋਆਂ ਖਿੱਚਣ ਨੂੰ ਵੀ ਬਹੁਤ ਵਧੀਆ ਹੈ ਬਣਿਆ ਹੋਇਆ ਹੈ ਅਤੇ ਮੈਨੂੰ ਉੱਥੇ ਫੋਟੋਆਂ ਖਿੱਚਣ ਲਈ ਬਹੁਤ ਵਧੀਆ ਲੱਗਿਆ ਸੁਖਨਾ ਲੇਕ ਜੋ ਕਿ ਚੰਡੀਗੜ੍ਹ ਵਿੱਚ ਹੈ ਉੱਥੇ ਇੱਕ ਝਰਨਾ ਵੀ ਹੈ ਅਤੇ ਉੱਥੇ ਉਸਦੇ ਆਲੇ ਦੁਆਲੇ ਫੁੱਲ ਵੀ ਲੱਗੇ ਹੋਏ ਹਨ ਉੱਥੇ ਦਾ ਵਾਤਾਵਰਨ ਬਹੁਤ ਸ਼ਾਂਤ ਅਤੇ ਬਹੁਤ ਵਧੀਆ ਹੈ